ਮੈਂ ਆਪਣੇ ਕੱਪੜੇ ਜਿਹੜੇ ਤਾਂ ਮੇਰੇ ਪਾਉਣ ਵਾਲੇ ਕੱਪੜੇ ਆ ਉਹ ਤਾਂ ਮੈਂ ਵਾਸ਼ਿੰਗ ਮਸ਼ੀਨ ਰਾਹੀਂ ਧੋ ਲੈਨਾ ਬਾਕੀ ਜਿਹੜੇ ਮੇਰੇ ਕੱਪੜੇ ਮਤਲਬ ਭਾਰੇ ਨੇ ਜਿਵੇਂ ਬੈਡਸ਼ੀਟ ਦਰੀਆਂ ਫਰਿੱਜ ਦੇ ਕਵਰ ਜਾਂ ਹੋਰ ਵੀ ਜਿਹੜੇ ਕਵਰ ਵਗੈਰਾ ਮੋਟੇ ਕੱਪੜੇ ਨੇ ਉਹਨਾਂ ਨੂੰ ਮੈਂ ਗਰਮ ਪਾਣੀ ਵਿੱਚ ਡੋਬ ਕੇ ਹੱਥਾਂ ਨਾਲੀ ਧੋ ਲੈਨਾ ਅਤੇ ਹਾਂ ਧੋਣ ਤੋਂ ਬਾਅਦ ਉਹਨਾਂ ਨੂੰ ਮੋਟੇ ਕੱਪੜੇ ਜਾਂ ਦੂਜੇ ਵੀ ਜਿਹੜੇ ਕੱਪੜੇ ਨੇ ਸਾਰੇ ਇਹਨਾਂ ਨੂੰ ਧੋਣ ਤੋਂ ਬਾਅਦ ਮੈਂ ਛੱਤ 'ਤੇ ਜਿਹੜੀ ਤਾਰ ਛੱਤ 'ਤੇ ਇੱਕ ਤਾਰ ਬੰਨੀ ਹੋਈ ਆ ਉਹ ਤਾਰ ਦੇ ਉੱਪਰ ਸੁੱਕਣ ਲਈ ਪਾ ਦਿੰਨਾ ਧੁੱਪ 'ਚ ਅਤੇ ਉਹਤੋਂ ਬਾਅਦ ਮੈਂ ਇਹ ਵੀ ਧਿਆਨ ਰੱਖਦਾਂ ਵੀ ਮੌਸਮ ਖਰਾਬ ਤਾਂ ਨਹੀਂ ਹੈਗਾ ਧੁੱਪ ਹੈਗੀ ਹੈ ਨਾ ਜੇ ਲੱਗਦਾ ਮੌਸਮ ਖਰਾਬ ਹੈ ਤਾਂ ਮੈਂ ਜਿਹੜੇ ਆਪਣੇ ਕੱਪੜੇ ਹੁੰਦੇ ਆ ਉਹਨਾਂ ਨੂੰ ਮੈਂ ਉੱਤੇ ਉੱਪਰ ਨਹੀਂ ਪਾਉਂਦਾ ਛੱਤ 'ਤੇ ਸੁੱਖ ਸੁੱਕਣੇ ਅਤੇ ਮੈਂ ਉਹਨਾਂ ਨੂੰ ਆਪਣਾ ਹੇਠਾਂ ਹੀ ਲਿਆਉਨਾ ਅੰਦਰ ਹੀ ਘਰ ਦੇ ਅੰਦਰ ਹੀ ਬਰੈਂਡੇ ਦੇ ਅੰਦਰ ਜਿਹੜੀ ਹੋਰ ਮੈਂ ਤਾਰ ਬੰਨੀ ਇੱਕ ਬਰੈਂਡੇ ਦੇ ਅੰਦਰ ਏ ਬੰਨੀ ਹੋਈ ਆ ਛੋਟੇ ਕੱਪੜੇ ਪਾਉਣ ਲਈ ਅਤੇ ਮੈਂ ਉਹ ਸਾਰੇ ਕੱਪੜੇ ਫਿਰ ਉਹਤੇ ਸੁਕਣੇ ਪਾ ਦਿੰਨਾ ਜੇ ਮੌਸਮ ਖਰਾਬ ਹੁੰਦਾ ਅਤੇ ਫਿਰ ਉੱਥੇ ਪੱਖਾ ਲਗਾ ਕੇ ਹੀ ਉਹ ਸੁੱਕਦੇ ਨੇ ਕੱਪੜੇ ਪੱਖੇ ਦੀ ਮਦਦ ਨਾਲ ਸਾਰੇ ਕੱਪੜੇ ਬਰੈਂਡੇ 'ਚ ਹੀ ਸੁੱਕ ਜਾਂਦੇ ਨੇ ਫਿਰ ਮੌਸਮ ਜਦੋਂ ਖਰਾਬ ਹੁੰਦਾ ਫਿਰ ਆਪਾਂ ਬਾਹਰ ਤਾਂ ਪਾ ਨਹੀਂ ਸਕਦੇ ਮੀਂਹ ਮੀਂਹ ਵਗੈਰਾ ਕਦੋਂ ਵੀ ਆ ਸਕਦਾ ਤਾਂ ਕਰਕੇ ਫਿਰ ਮੈਂ ਅੰਦਰੇ ਹੀ ਪਾ ਲੈਂਦਾ ਹੁੰਦਾ ਸਾਰੇ ਹੀ ਕੱਪੜੇ